ਹਾਂਜੀ ਪੰਜਾਬ ਵਿੱ ਚਕਿਹੜੇ ਕਿਹੜੇ ਵੱਡੇ ਸੁ ਸੁਧਾਰ ਕਰਨ ਵਾਲੇ ਆ ਇਹ ਸਾਰਿਆਂ ਨੂੰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਸਾਨੂੰ ਜ਼ਿਆਦਾ ਪਤਾ ਇਸ ਕਰਕੇ ਜ਼ਿਆਦਾ ਪਤਾ ਕਿ ਸਾਡੇ ਨਾਲ ਰੋਜ਼ ਦੀ ਕਹਾਣੀਆਂ ਹੁੰਦੀਆਂ ਪਹਿਲਾਂ ਤਾਂ ਪ ਪਾਣੀ ਦੀ ਦੇਖੋ ਤੁਸੀਂ ਪਾਣੀ ਆਉਂਦਾ ਪਾਣੀ ਬਹੁਤ ਵਧੀਆ ਆਉਂਦਾ ਲੇਕਿਨ ਉਹ ਉਹਦੇ 'ਚ ਵੀ ਗੰਦ ਗੰਦਗੀ ਹੁੰਦੀ ਪਾਣੀ ਗੰਦਾ ਆਉਂਦਾ ਬੜੀ ਸ਼ਿਕਾਇਤ ਕਰੀ ਦੀ ਹੈ ਸੁਣਦੇ ਹੀ ਨਹੀਂ ਜੇ ਸੁਣਦੇ ਆ ਫਿਰ ਸੁਧਾਰ ਨਹੀਂ ਹੋ ਰਿਹਾ ਇਸ ਤਰ੍ਹਾਂ ਤੁਸੀਂ ਲਾਈਟਾਂ ਦੇਖੋ ਬਿਜਲੀ ਦੇਖੋ ਤਾਰਾਂ ਇੱਕ ਦੂਸਰੇ ਦੇ ਨਾਲ ਰਲ ਜਾਂਦੀਆਂ ਉਹ ਵਜ ਬੱਤੀ ਚਲ ਜਾਂਦੀ ਘਰਾਂ ਦੀ ਉਹਨਾਂ ਸ਼ਿਕਾਇਤਾਂ ਕਰੀ ਦੀਆਂ ਬਿਜਲੀ ਘਰ 'ਚ ਉਹ ਕਦੇ ਆਉਂਦੇ ਆ ਕਦੇ ਆਉਂਦੇ ਨਹੀਂ ਕਈ ਕਈ ਵਾਰ ਸਾਰਾ ਸਾਰਾ ਦਿਨ ਹੀ ਨਹੀਂ ਆਉਂਦੇ ਫਿਰ ਇਹ ਇੰਨਾ ਕਿੰਨੇ ਕਿੰਨੇ ਮਤਲਬ ਕਰਦੇ ਹਾਂ ਸ਼ਿਕਾਇਤ ਕਰਦੇ ਹਾਂ ਇਸ ਤਰ੍ਹਾਂ ਹੀ ਸਿਵਲ ਓੱਥੇ ਸਿਵਲ ਹਸਪਤਾਲ ਜਾ ਕੇ ਦੇਖ ਲਓ ਕੋਈ ਵੀ ਕੰਮ ਜਾ ਕੇ ਦੇਖ ਲਓ ਸਾਰਾ ਸਾਰਾ ਦਿਨ ਲੱਗ ਜਾਂਦਾ ਕੋਈ ਡਾਕਟਰ ਛੇਤੀ ਕੀਤਿਆਂ ਉਹਨਾਂ ਨੂੰ ਬਹੁਤ ਕੋਈ ਜਾਣਦਾ ਹੁੰਦਾ ਉਹਨਾਂ ਦੀ ਵੀ ਪ ਪਹਿਲਾ ਸੁਣਵਾਈ ਹੋਈ ਜਾਂਦੀ ਦੂਸਰੇ ਦੀ ਹੁੰਦੀ ਨਹੀਂ ਬਚਾਰਾ ਚੱਕਰ ਏ ਕੱਟਦਾ ਰਹਿ ਜਾਂਦਾ ਕੀ ਕਰੇ ਪਰੇਸ਼ਾਨ ਹੋ ਜਾਂਦਾ ਇੰਨਾ ਪਰੇਸ਼ਾਨ ਹੋ ਜਾਂਦਾ ਵੀ ਜਾਣਾ ਹੀ ਬੰਦ ਕਰ ਦਿੰਦਾ ਉਹ ਕਹਿੰਦਾ ਮੈਂ ਮਤਲਬ ਪ੍ਰਾਈਵੇਟ ਦੇਖਲਾਂਗਾ ਇਹਦੇ ਨਾਲ ਤਾਂ ਇਹਦਾ ਮਤਲਬ ਕੋਈ ਸੁਧਾਰ ਨਹੀਂ ਕਰਦੇ ਪਏ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਪੰਜਾਬ ਪੰਜਾਬ ਦੇ ਕੋਈ ਵੀ ਜਿਹੜਾ ਮਹਿਕਮਾ ਨਾ ਉਹ ਗੌਰਮੈਂਟ ਵੱਲੋਂ ਤਾਂ ਬਹੁਤ ਅੱਛਾ ਵਾ ਲੇਕਿਨ ਜਿਹੜਾ ਅੱਗੋਂ ਕਰਦੇ ਆ ਧੰਨਵਾਦ